ਹਾਂਜੀ ਮੈਂ ਆਪਣੇ ਰਾਜ ਪੰਜਾਬ ਤੋਂ ਬਾਹਰ ਕਾਫ਼ੀ ਵਾਰ ਯਾਤਰਾ ਕੀਤੀ ਹੈ ਕਦੇ ਵਰਿੰਦਾਵਨ ਕਦੇ ਮਸੂਰੀ ਮਨਾਲੀ ਡਲਹੌਜੀ ਗੁੜਗਾਉਂ ਮੈਂ ਬਹੁਤ ਜਗ੍ਹਾਵਾਂ 'ਤੇ ਘੁੰਮੀ ਹਾਂ ਅਲੱਗ ਅਲੱਗ ਥਾਵਾਂ 'ਤੇ ਘੁੰਮਣ ਦਾ ਅਲੱਗ ਅਲੱਗ ਉਦੇਸ਼ ਹੈ ਜਿਵੇਂ ਕਿ ਵਰਿੰਦਾਵਨ ਜਾਣ ਦਾ ਉਦੇਸ਼ ਹੈ ਭਗਵਾਨ ਦੇ ਦਰਸ਼ਨ ਕਰਨਾ ਰਿਲੀਜੀਅਸ ਜਗ੍ਹਾਵਾਂ 'ਤੇ ਘੁੰਮਣਾ ਪੋਜੀਟਿਵ ਵਾਈਬਸ ਲੈਣਾ ਵਧੀਆ ਵਧੀਆ ਸਿੱਖ ਕੇ ਆਉਣਾ ਕੁਛ ਭਗਵਾਨ ਦੇ ਅਲੱਗ ਅਲੱਗ ਰੂਪਾਂ ਨੂੰ ਦੇਖਣਾ ਅਤੇ ਮਨਾਲੀ ਮਸੂਰੀ ਘੁੰਮਣ ਦਾ ਉਦੇਸ਼ ਹੈ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਜਾਣਾ ਥੋੜ੍ਹਾ ਜਿਹਾ ਆਪਣੇ ਦੇਸ਼ ਨਾਲੋਂ ਆਪਣੇ ਰਾਜ ਨਾਲੋਂ ਆਪਣੇ ਸ਼ਹਿਰ ਨਾਲੋਂ ਥੋੜ੍ਹਾ ਜਿਹਾ ਵੱਖਰਾ ਘੁੰਮਣਾ ਵੱਖਰੀ ਵੱਖਰੀ ਥਾਵਾਂ ਵੇਖਣਾ ਵੱਖਰਾ ਵੱਖਰਾ ਐਡਵੈਂਚਰ ਕਰਨਾ ਉਹਨਾਂ ਦਾ ਰਹਿਣ ਸਹਿਣ ਦਾ ਬਹਿਣ ਖਲੋਣ ਦਾ ਤਰੀਕਾ ਦੇਖਣਾ ਉਨ੍ਹਾਂ ਦੇ ਨਾਲ ਵਧੀਆ ਪਹਾੜਾਂ ਦੀਆਂ ਹਵਾਵਾਂ ਠੰਡੀਆਂ ਹਵਾਵਾਂ ਦੇਖਣਾ ਸਨੋਅ ਦੇਖਣਾ ਜੋ ਕਿ ਪੰਜਾਬ ਦੇ ਵਿੱਚ ਨਹੀਂ ਪੈਂਦੀ ਉਨ੍ਹਾਂ ਦੇ ਖਾਣੇ ਟੇਸਟ ਕਰਨਾ ਵੱਖਰੇ ਵੱਖਰੇ ਅਤੇ ਹੋਰ ਵੀ ਬਹੁਤ ਕੁਛ ਇਹਨਾਂ ਸਾਰੀਆਂ ਥਾਵਾਂ 'ਤੇ ਘੁੰਮ ਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਧੰਨਵਾਦ